ਲਿਖਣ ਦੇ ਲਈ ਸਭ ਤੋਂ ਵੱਧ ਚੁਣੌਤੀਪੂਰਨ ਪਹਿਲੂ ਇਹ ਹੈ ਕਿ ਵਿਦੇਸ਼ੀ ਭਾਸ਼ਾਵਾਂ ਨੂੰ ਸਿੱਖਣਾ ਜਾਂ ਉਹਨਾਂ ਦੇ ਪ੍ਰਤੀ ਕਿਸੇ ਵਿਸ਼ੇ ਨੂੰ ਲੱਭ ਕੇ ਉਸਦੇ ਉੱਤੇ ਲਿਖਣਾ ਬਹੁਤ ਹੀ ਕਠਿਨਾਈ ਭਰਪੂਰ ਰਿਹਾ ਹੈ ਕਿਉਂਕਿ ਰਚਨਾਤਮਕ ਵਿਸ਼ਾ ਜਦੋਂ ਤੱਕ ਹਿਰਦੇ ਨੂੰ ਛੋਹ ਕੇ ਨਾ ਜਾਵੇ ਓਸ ਨੂੰ ਅਨੁਭਵ ਨਹੀਂ ਕੀਤਾ ਜਾ ਸਕਦਾ